ਅੱਜ ਕੱਲ੍ਹ ਕੁਛ ਵੀ ਗਾਣ ਵਾਸਤੇ ਸਾਡੇ ਮੂੰਹ ਵੀ ਅਤੇ ਹਾਵ ਭਾਵ ਤਾਂ ਬਦਲਦੇ ਹੀ ਹਨ ਕਿਉੰਕਿ ਆਪਾਂ ਹਰ ਇੱਕ ਆਵਾਜ਼ ਨੂੰ ਆਪਣੇ ਦਿਲੋਂ ਕੱਢਦੇ ਹਨ ਅਤੇ ਉਹ ਆਵਾਜ਼ ਕੱਢਣ ਵਾਸਤੇ ਸਾਡੇ ਮੂੰਹ ਵਿੱਚ ਖੁਸ਼ੀ ਦੁੱਖ ਦੇ ਦੇ ਹਾਵ ਭਾਵ ਤਾਂ ਆਉਂਦੇ ਹੀ ਹਨ ਜਿਵੇਂ ਆਪਾਂ ਕੋਈ ਦੁਖੀ ਗਾਣਾ ਗਾਈਏ ਤਾਂ ਸਾਡੇ ਵੱਲ ਲੋਕ ਦੇਖਦੇ ਹਨ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਆਪਾਂ ਰੋਣ ਵਾਲੇ ਹਨ ਕਿਉਂਕਿ ਸਾਡੇ ਆਪਾਂ ਹਰ ਇੱਕ ਆਵਾਜ਼ ਆਪਣੇ ਦਿਲੋਂ ਕੱਢਦੇ ਹਨ ਗਾਉਣ ਵੇਲੇ ਅਤੇ ਜੇ ਆਪਾਂ ਕੋਈ ਖੁਸ਼ੀ ਵਾਲੇ ਗਾਣੇ ਗਾਈਏ ਤਾਂ ਲੋਕਾਂ ਨੂੰ ਇੱਦਾਂ ਲੱਗਦਾ ਜਿੱਦਾਂ ਆਪਾਂ ਬੜੇ ਖੁਸ਼ ਹਨ ਅਤੇ ਖੁਸ਼ ਹੋ ਕੇ ਗਾਣੇ ਗਾ ਰਹੇ ਕਿਉਂਕਿ ਆਪਾਂ ਉਸ ਆਵਾਜ਼ ਨੂੰ ਵੀ ਆਪਣੇ ਦਿਲੋਂ ਕੱਢਦੇ ਹਨ ਅਤੇ ਜੇ ਕੋਈ ਬੰਦਾ ਬਿਨਾਂ ਕੁਝ ਅਭਿਆਸ ਤੋਂ ਗਾਣੇ ਗਾਉਣਾ ਚਾਹੁੰਦਾ ਹਨ ਅੱਜ ਕੱਲ੍ਹ ਹਰ ਇੱਕ ਚੀਜ਼ ਕਰਨ ਵਾਸਤੇ ਮਿਹਨਤ ਤਾਂ ਕਰਨੀ ਪੈਂਦੀ ਹਨ ਪਰ ਅੱਜ ਕੱਲ੍ਹ ਬੜਾ ਹੀ ਜ਼ਿਆਦਾ ਚੀਜ਼ਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ ਜਿੱਦਾਂ ਕਿ ਕੁਛ ਵੀ ਗਾਉਣ ਤੋਂ ਪਹਿਲਾਂ ਕੋਈ ਵੀ ਠੰਡੀ ਚੀਜ਼ ਨਾ ਖਾਉ ਕਿਉਂਕਿ ਠੰਡੀ ਚੀਜ਼ ਖਾਣ ਨਾਲ ਬੜੀ ਜ਼ਿਆਦਾ ਇਹ ਚਾਂਸਿਸ ਹੁੰਦੇ ਹਨ ਕਿ ਤੁਹਾਡੀ ਆਵਾਜ਼ ਭਾਰੀ ਹੋ ਜਾਵੇ ਅਤੇ ਭਾਰੀ ਹੋਣ ਕਾਰਨ ਤੁਹਾਡੀ ਆਵਾਜ਼ ਬਹਿ ਵੀ ਸਕਦੀ ਹੈ ਅਤੇ ਤੁਹਾਡੀ ਆਵਾਜ਼ ਖਰਾਬ ਹੋ ਸਕਦੀ ਹੈ ਅਤੇ ਉਹ ਕਦੇ ਵਾਰ ਥੋੜ੍ਹੇ ਚਿਰ ਵਾਸਤੇ ਵੀ ਹੋ ਸਕਦੀ ਹੈ ਅਤੇ ਕਦੇ ਵਾਰ ਹਮੇਸ਼ਾਂ ਵਾਸਤੇ ਵੀ ਇਸ ਲਈ ਜ਼ਿਆਦਾਤਰ ਸਿੰਗਰ ਕੋਈ ਵੀ ਠੰਡੀ ਚੀਜ਼ ਨਹੀਂ ਖਾਂਦੇ ਅਤੇ ਜੇ ਖਾਉਗੇ ਵੀ ਤਾਂ ਬਹੁਤ ਥੋੜ੍ਹੀ ਥੋੜ੍ਹੀ ਜਿਹਦੇ ਕਾਰਨ ਉਹਨਾਂ ਦੀ ਆਵਾਜ਼ ਠੀਕ ਰਹੇ ਅਤੇ ਉਹ ਵਧੀਆ ਗਾਉਂਦੇ ਰਹੇ ਆਪਣੀ ਪੂਰੀ ਜ਼ਿੰਦਗੀ ਅਤੇ ਹਮੇਸ਼ਾਂ ਇੱਦਾਂ ਹੀ ਆਪਣੇ ਕਰੀਅਰ ਵਿੱਚ ਅੱਗੇ ਵੱਧਦੇ ਗਏ ਅਤੇ ਉਹ ਅੱਗੇ ਤਰੱਕੀ ਕਰਦੇ ਰਹੇ